ਸਾਡੀ ਸਥਾਨਕ ਭਾਸ਼ਾ ਵਿੱਚ ਇੱਕ ਮੇਰਾ ਮਨਪਸੰਦੀਦਾ ਸੀਰੀਅਲ ਬਾਬਲ ਦਾ ਵਿਹੜਾ ਹੈ ਜੋ ਕਿ ਮੈਨੂੰ ਉਹ ਸੀਰੀਅਲ ਬਹੁਤ ਪਸੰਦ ਹੈ ਉਹ ਸੀਰੀਅਲ ਤੋਂ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਪ੍ਰੇਰਨਾ ਮਿਲੀ ਹੈ ਮੈਨੂੰ ਉਹ ਸੀਰੀਅਲ ਦੇਖਣ ਵਿੱਚ ਬਹੁਤ ਆਨੰਦ ਮਿਲਦਾ ਹੈ ਉਹ ਸੀਰੀਅਲ ਮੈਂ ਯੂਟੀਊਬ ਉੱਪਰ ਦੇਖਦੀ ਹਾਂ ਉਸ ਸੀਰੀਅਲ ਦੀ ਸ਼ੂਟਿੰਗ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਈ ਹੈ ਉਹ ਸੀਰੀਅਲ ਦੇਖ ਕੇ ਮੈਂ ਮੇਰਾ ਦਿਨ ਬਹੁਤ ਆਰਾਮ ਨਾਲ ਬੀਤ ਜਾਂਦਾ ਹੈ ਇਸ ਲਈ ਉਹ ਸੀਰੀਅਲ ਮੈਂ ਬਹੁਤ ਦੇਖਦੀ ਹਾਂ ਇਸ ਦੇ ਨਾਲ ਨਾਲ ਹਿੰਦੀ ਭਾਸ਼ਾ ਵਿੱਚ ਮਨੋਰੰਜਨ ਪ੍ਰੋਗਰਾਮ ਦੀ ਕਪਿਲ ਸ਼ਰਮਾ ਸ਼ੋ ਹੈ ਉਹ ਵੀ ਮੈਨੂੰ ਦੇਖਣਾ ਬਹੁਤ ਪਸੰਦ ਹੈ ਧੰਨਵਾਦ